ਪੰਜਾਬ ਵਿੱਚ ਮੌਸਮ ਬਦਲਦੇ ਹੀ ਰਹਿੰਦੇ ਹਨ ਕਈ ਵਾਰ ਗਰਮ ਅਤੇ ਕਈ ਵਾਰ ਸਰਦੀ ਅਤੇ ਕਦੇ ਬਰਸਾਤ ਮੈਂ ਸਭ ਸਭ ਮੌਸਮਾਂ ਵਿੱਚ ਦੌੜਨਾ ਨਹੀਂ ਛੱਡ ਛੱਡਦਾ ਮੈਨੂੰ ਦੌੜ ਲਾਉਣ ਦਾ ਬਹੁਤ ਹੀ ਸ਼ੌਂਕ ਆ ਮੈਂ ਰੋਜ਼ ਦੌੜ ਲਾਉਂਦਾ ਹਾਂ ਗਰਮੀ ਦੇ ਮੌਸਮ ਵਿੱਚ ਜਦੋਂ ਮੈਂ ਦੌੜ ਲਗਾਉਂਦਾ ਹਾਂ ਤਾਂ ਪਸੀਨਾ ਬਹੁਤ ਜ ਜ਼ਿਆਦਾ ਆਉਂਦਾ ਹੈ ਸਰਦੀ ਵਿੱਚ ਦੌੜ ਲਾਉਣ ਦਾ ਬਹੁਤ ਮਜ਼ਾ ਆਉਂਦਾ ਹੈ ਪਸੀਨਾ ਵੀ ਘੱਟ ਆਉਂਦਾ ਹੈ ਸਰਦੀ ਵਿੱਚ ਦੌੜ ਲਾਉਣ ਅਤੇ ਜ਼ਿਆਦਾ ਫਾਇਦੇ ਹਨ ਬਰਸਾਤ ਵਿੱਚ ਦੌੜ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਦੌੜ ਲਾਉਣਾ ਚਾਹੇ ਕਿਉਂਕਿ ਪੈਰ ਮਲੀਪ ਹੋਣ ਦਾ ਖਤਰਾ ਹੁੰਦਾ ਹੈ ਸੋ ਬਹੁਤ ਧਿਆਨ ਨਾਲ ਦੌੜ ਲਾਉਣੀ ਪੈਂਦੀ ਹੈ